ਹੈਲੋ ਹਾਂਜੀ ਭਾਅ ਜੀ ਓਲਾ ਤੋਂ ਬੋਲ ਰਹੇ ਹੋ ਜੀ ਮੈਂ ਕੈਬ ਬੁੱਕ ਕੀਤੀ ਸੀ ਸਟੇਸ਼ਨ ਤੋਂ ਗੋਲਡਨ ਗੇਟ ਲਈ ਕਿੰਨੀ ਦੇਰ ਤੱਕ ਪਹੁਚੂਗੀ ਅੱਛਾ ਪਹੁੰਚ ਗਏ ਹੋ ਮੈਂ ਫਰੰਟ 'ਤੇ ਸਟੇਸ਼ਨ ਦੇ ਫਰੰਟ 'ਤੇ ਖੜ੍ਹਾ ਐਂਟਰੀ 'ਤੇ ਤੁਸੀਂ ਵੀ ਉੱਥੇ ਹੀ ਹੋ ਅੱਛਾ ਦਿਖ ਨਹੀਂ ਰਹੇ ਅੱਛਾ ਜੀ ਦਿਖਗੇ ਦਿਖਗੇ ਆ ਗਿਆ ਮੈਂ ਆ ਗਿਆ ਥੈ ਧੰਨਵਾਦ ਭਾਅ ਜੀ ਤੁਸੀਂ ਮੈਨੂੰ ਟੈਮ ਸਿਰ ਲਾਹ ਤਾ ਅਤੇ ਪੇਮੈਂਟ ਤੁਸੀਂ ਔਨਲਾਈਨ ਲੈ ਲੈਂਦੇ ਹੋ ਪੇਅਟੀਐਮ ਨਹੀਂ ਲੈਂਦੇ ਕੈਸ਼ ਹੀ ਲੈਂਦੇ ਹੋ ਪਹਿਲਾਂ ਤਾਂ ਲੈ ਲੈਂਦੇ ਸੀਗੇ ਹਾਂਜੀ ਕੱਲ੍ਹ ਤਾਂ ਸਾਰੇ ਡਿਜੀਟਲ ਪੇਮੈਂਟ ਲੈ ਲੈਂਦੇ ਆ ਤੁਸੀਂ ਤਾਂ ਕੈਬ ਵਾਲੇ ਹੋ ਤੁਸੀਂ ਨਹੀਂ ਲੈ ਰਹੇ ਅੱਛਾ ਪਿੱਛੋਂ ਇੰਸਟ੍ਰਕਸ਼ਨ ਓਕੇ ਓਕੇ ਕੈਸ਼ ਮੈਨੂੰ ਚੈੱਕ ਕਰਨਾ ਪੈਣਾ ਭਾਅ ਜੀ ਦੋ ਮਿੰਟ ਰੁਕਿਓ ਮੈਂ ਆਪਣੀ ਜੇਬ ਚੈੱਕ ਕਰ ਲਵਾਂ ਜਰਾ ਮੈਂ ਜ਼ਿਆਦਾਤਰ ਕੈਸ਼ ਰੱਖਦਾ ਨਹੀਂ ਕਿਉਂਕਿ ਸਾਰੇ ਪਾਸੇ ਉਹ ਪੈਅਟੀਐੱਮ ਵਗੈਰਾ ਚੱਲ ਪੈਂਦਾ ਹਾਂ ਆਹ ਮਿਲ ਗਿਆ ਭਾਅ ਜੀ ਸੌ ਰੁਪਇਆ ਲੱਭ ਗਿਆ ਆਹ ਲਉ ਚੇਂਜ ਹੈਗਾ ਤੁਹਾਡੇ ਕੋਲ ਠੀਕ ਠੀਕ ਚਲੋ ਧੰਨਵਾਦ ਭਾਅ ਜੀ ਤੁਸੀਂ ਮੈਨੂੰ ਲਾਹ ਤਾ ਟੈਮ ਸਿਰ ਅਤੇ ਬਾਕੀ ਤੁਹਾਡੀ ਰੇਟਿੰਗ ਮੈਂ ਸਹੀ ਦੇ ਦਿੰਦਾ ਥੈਂਕ ਯੂ ਸੋ ਮਚ ਧੰਨਵਾਦ